ਹੈਲੋ ਸਤਿ ਸ਼੍ਰੀ ਅਕਾਲ ਕੌਣ ਕੌਣ ਬੋਲਣ ਦੇ ਹਾਂਜੀ ਹਾਂਜੀ ਭਾਅ ਜੀ ਉਹੀ ਬੋਲਣ ਦਿਆਂ ਵਧੀਆ ਭਾਅ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਭਾਅ ਜੀ ਦੱਸੋ ਅੱਛਾ ਅੱਛਾ ਯਾਮਾ ਕੰਪਨੀ ਦਾ ਭਾਅ ਜੀ ਠੀਕ ਠੀਕ ਆ ਭਾਅ ਜੀ ਦੱਸੋ ਭਾਅ ਜੀ ਆਪਣੇ ਕੋਲ ਦਸ ਹਜ਼ਾਰ ਦਾ ਇੱਥੇ ਇਕਦਮ ਫਸਟ ਕਲਾਸ ਮਾਲ ਭਾਅ ਜੀ ਬਿਲਕੁਲ ਸਹੀ ਮਾਲ ਆ ਹਜੇ ਤੁਹਾਨੂੰ ਘੱਟ ਕਰਕੇ ਦੱਸਣ ਦਿਆਂ ਅਸਲ 'ਚ ਤਾਂ ਇਹਦਾ ਰੇਟ ਬਾਰ੍ਹਾਂ ਹਜ਼ਾਰ ਦੇ ਆਸ ਪਾਸ ਹੈ ਚਲੋ ਤੁਹਾਡੇ ਕਰਕੇ ਨੌ ਹਜ਼ਾਰ ਲਾ ਦਿੰਦੇ ਹਾਂ ਅਤੇ ਇੱਕ ਸਾਲ ਦੀ ਨਾਲ ਤੁਹਾਨੂੰ ਵਰੰਟੀ ਦੇ ਦਿੰਦੇ ਹਾਂ ਨਹੀਂ ਨਹੀਂ ਭਾਅ ਜੀ ਔਨਲਾਈਨ ਵਰੰਟੀ ਨਹੀਂ ਦਿੰਦੇ ਕੀ ਪਤਾ ਉਹਨਾ ਕੋਲ ਪੁਰਾਣਾ ਮਾਲ ਪਿਆ ਹੋਵੇ ਆਪਣੇ ਤੁਸੀਂ ਇੱਥੇ ਪੂਰਾ ਚੈੱਕ ਕਰਕੇ ਲੈ ਕੇ ਜਾਣਾ ਨਾ ਨਾਲੇ ਤੁਹਾਡੇ ਹੱਥ 'ਚ ਸੈਟਿਸਫਾਈਡ ਹੋਣੀ ਚੀਜ਼ ਚਲੋ ਵੱਧ ਤੋਂ ਵੱਧ ਤੁਹਾਨੂੰ ਸਾਢੇ ਅੱਠ ਤੱਕ ਲਾ ਦਿੰਦੇ ਹਾਂ ਇਸ ਤੋਂ ਥੱਲੇ ਭਾਅ ਜੀ ਮੈਂ ਵੀ ਨਹੀਂ ਨਾ ਜਾ ਸਕਦਾ ਹਮ ਕੋਈ ਸੀਨ ਨਹੀਂ ਓਕੇ ਬਾਏ